ਹਾਂਜੀ ਮੇਰਾ ਇੱਕ ਬਹੁਤ ਚੰਗਾ ਦੋਸਤ ਹੈ ਵਿਵੇਕ ਸਚਦੇਵਾ ਜਿਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਵੀ ਉਹਦੇ ਕੋਲ ਕਾਲੇਜ ਪੱਧਰ ਦੀ ਡਿਗਰੀ ਵੀ ਸੀ ਅਤੇ ਇਸ ਤੋਂ ਇਲਾਵਾ ਉਸਨੇ ਬਹੁਤ ਸਾਰੀ ਹੋਰ ਪੜ੍ਹਾਈ ਕੀਤੀ ਹੋਈ ਸੀ ਜਿਸਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਉਸ ਵੱਲੋਂ ਬੜੀ ਮਿਹਨਤ ਨਾਲ਼ ਬਹੁਤ ਆਪਣੇ ਮਿਡਲ ਕਲਾਸ ਤੋਂ ਉੱਪਰ ਉੱਠ ਕੇ ਉਹਨੇ ਪੜ੍ਹਾਈ ਕਰਨ ਤੋਂ ਬਾਅਦ ਆਪਣਾ ਜਿਹੜਾ ਕੰਮ ਆਪਣੇ ਲਈ ਬਹੁਤ ਬੇਹਤਰੀ ਵਾਲੇ ਕੰਮ ਕੀਤੇ ਹਨ ਉਸ ਵੱਲੋਂ ਪੜ੍ਹਾਈ ਦੇ ਪੜਾਈਸ ਪੜ੍ਹਾਈ ਦੇ ਡਿਗਰੀ ਦੇ ਮੁੱਖ ਰੱਖਦੇ ਹੋਏ ਇਸ ਡਿਗਰੀ ਦੇ ਬੇਸ 'ਤੇ ਹੀ ਸਟੱਡੀ ਵੀਜ਼ਾ ਲੈ ਕੇ ਵਿਦੇਸ਼ ਗਿਆ ਸੀ ਅਤੇ ਉਹਨੂੰ ਵਿਦੇਸ਼ ਗਏ ਨੂੰ ਕਾਫ਼ੀ ਸਾਲ ਹੋ ਚੁੱਕੇ ਹਨ ਇਸ ਇਸ ਪੜ੍ਹਾਈ ਦੇ ਬੇਸ 'ਤੇ ਹੀ ਉਸ ਵੱਲੋਂ ਵਿਦੇਸ਼ ਵਿੱਚ ਵਿਦੇਸ਼ੀ ਨਿਊਜ਼ੀਲੈਂਡ ਦੇ ਵਿੱਚ ਸਰਕਾਰੀ ਬੈਂਕ ਵਿੱਚ ਅੱਜ ਕੱਲ੍ਹ ਉਹ ਜੋਬ ਕਰ ਰਿਹਾ ਹੈ ਉਸ ਵੱਲੋਂ ਆਪਣੀ ਫੈਮਿਲੀ ਨੂੰ ਆਪਣੀ ਫੈਮਲੀ ਨੂੰ ਗਰੀਬੀ ਤੋਂ ਚੁੱਕ ਕੇ ਹਾਈ ਸੋਸਾਇਟੀ ਵਿੱਚ ਸ਼ਿਫਟ ਕਰ ਚੁੱਕਾ ਹੈ ਅੱਜ ਉਹਦਾ ਬਹੁਤ ਵਧੀਆ ਕੰਮਕਾਰ ਅਤੇ ਉਹਦੇ ਕੋਲ ਆਪਣਾ ਮਕਾਨ ਆਪਣੀ ਗੱਡੀ ਅਤੇ ਉਸ ਵੱਲੋਂ ਹੁਣ ਇਸ ਸਮੇਂ ਜੋ ਜਿਹੜੀ ਉਹਦੇ ਲਾਈਫਸਟਾਈਲ ਹੈ ਉਹ ਬਹੁਤ ਵਧੀਆ ਹੋ ਚੁੱਕਾ ਹੈ ਮੈਂ ਉਸ ਉਸ ਤੋਂ ਬਹੁਤ ਖੁਸ਼ ਹਾਂ ਕਿ ਮੇਰੇ ਦੋਸਤ ਵੱਲੋਂ ਸਮੇਂ ਸਮੇਂ 'ਤੇ ਮੈਨੂੰ ਜੋ ਮਿਲਣ ਆਉਂਦਾ ਹੈ ਭਾਰਤ ਜਦੋਂ ਆਉਂਦਾ ਹੈ ਤਾਂ ਮੈਨੂੰ ਮਿਲਦਾ ਵੀ ਹੈ ਅਤੇ ਉਸ ਉਹ ਇੱਕ ਅਜਿਹਾ ਬੰਦਾ ਹੈ ਜਿਸ ਨੇ ਆਪਣੀ ਪੜ੍ਹਾਈ ਦੇ ਸਿਰ 'ਤੇ ਹੀ ਸਭ ਕੁਝ ਹਾਸਲ ਕੀਤਾ ਹੈ